ਬਗੀਚਾ ਜਿਹੜਾ ਕਿ ਛੋਟੀ ਕਿਆਰੀ ਆ ਉਹ ਤਿਆਰ ਕੀਤੀ ਜਾਂਦੀ ਹੈ ਘਰ ਤਾਂ ਉਹਨੂੰ ਤਿਆਰ ਕਰਨ ਦਾ ਜਾਂ ਬਗੀਚਾ ਬਣਾਉਣ ਦਾ ਸ਼ੌਂਕ ਹੋਣਾ ਜਿਹੜਾ ਉਹ ਪਹਿਲਿਆਂ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਉਹਨੂੰ ਸ਼ੌਂਕ ਨਾਲ ਤਿਆਰ ਕੀਤਾ ਜਾਵੇ ਤਾਂ ਬਗੀਚੇ ਦੇ ਵਿੱਚ ਪੌਦੇ ਲਗਾਉਣ ਲਈ ਅਸੀਂ ਕੁਛ ਕੁ ਜਿਹੜੇ ਪੌਦੇ ਹੁੰਦੇ ਜਿਨ੍ਹਾਂ ਦੇ ਵਿੱਚੋਂ ਖ਼ਾਸ ਸਜਾਵਟ ਵਾਲੇ ਜਾਂ ਕੋਈ ਫੁੱਲਾਂ ਵਾਲੇ ਜਿੰਨ੍ਹਾਂ ਨੂੰ ਨਰਸਰੀ ਤੋਂ ਪ੍ਰਾਪਤ ਕੀਤਾ ਜਾਂਦਾ ਤਾਂ ਉਹ ਪੌਦੇ ਜਿਹੜੇ ਨਰਸਰੀ 'ਚੋ ਪ੍ਰਾਪਤ ਕੀਤੇ ਜਾ ਸਕਦੇ ਆ ਉਹ ਉਹਨਾਂ ਨੂੰ ਉੱਥੋਂ ਖਰੀਦਿਆ ਜਾ ਸਕਦਾ ਕੁਛ ਜਿਹੜੇ ਕੁਛ ਮੰਨ ਲਓ ਕਿ ਬਗੀਚੇ ਦੇ ਵਿੱਚ ਕੋਈ ਸਬਜ਼ੀਆਂ ਨੇ ਜਿਹੜੀਆਂ ਸੀਜ਼ਨਲ ਸਬਜ਼ੀਆਂ ਦੇ ਪੌਦੇ ਨੇ ਜਾਂ ਕੋਈ ਜਿਹੜੇ ਉਹਨਾਂ ਦੇ ਜਿਹੜੇ ਮਾਰਕੀਟ ਦੇ ਵਿੱਚੋਂ ਬੀਜ਼ ਜਿਹੜੇ ਬੀਜ਼ ਲਿਆ ਕੇ ਉਹਨਾਂ ਨੂੰ ਘਰ ਹੀ ਤਿਆਰ ਕੀਤਾ ਜਾ ਸਕਦਾ ਉਹਨਾਂ ਦੇ ਬੀਜ਼ ਜਦੋਂ ਬੋਏ ਜਾਂਦੇ ਆ ਤਾਂ ਉਹ ਉਹਨਾਂ ਦੀ ਉਹਨਾਂ ਨੂੰ ਘਰ ਉਗਾਇਆ ਜਾ ਸਕਦਾ ਬਗੀਚੇ ਵਿੱਚ ਜਿਹੜੇ ਉਹ ਪੌਦੇ ਜਿਹੜੇ ਪ੍ਰਾਪਤ ਕੀਤੇ ਜਾ ਸਕਦੇ ਆ ਤਾਂ ਇਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਸਾਨੂੰ ਜਿਹੜੀ ਔਨਲਾਈਨ ਸਰੋਤਾਂ ਤੋਂ ਮਿਲ ਜਾਂਦੀ ਹੈ ਕਿ ਕਿਹੜੇ ਬੀਜ਼ ਨੂੰ ਕਿਵੇਂ ਉਗਾਉਣਾ ਜਾਂ ਉਹਨੂੰ ਕਿਵੇਂ ਤਿਆਰ ਕਰਕੇ ਉਹਦੀ ਪਾਲਣਾ ਕਿਵੇਂ ਕਰਨੀ ਹੈ ਜਾਂ ਉਹਨੂੰ ਕਿਹੜੀਆਂ ਕਿਹੜੀਆਂ ਖਾਦਾਂ ਜਿਹੜੀਆਂ ਉਹ ਜਿਹੜੀਆਂ ਉਹਨਾਂ ਬਾਰੇ ਥੋੜ੍ਹੀ ਥੋੜ੍ਹੀ ਜਿਹੜੀ ਜਾਣਕਾਰੀ ਆ ਬਗੀਚਾ ਤਿਆਰ ਕਰਨ ਲਈ ਉਹ ਜ਼ਰੂਰੀ ਆ ਕਿ ਉਹਨੂੰ ਕੁਛ ਪੌਦੇ ਹੁੰਦੇ ਜਿੰਨ੍ਹਾਂ ਨੂੰ ਜ਼ਿਆਦਾ ਸਰਦੀ ਤੋਂ ਜ਼ਿਆਦਾ ਧੁੱਪ ਤੋਂ ਜਿਹੜਾ ਉਹ ਬਚਾ ਕੇ ਰੱਖਣਾ ਤਾਂ ਬਗੀਚੇ ਦੇ ਵਿੱਚ ਜਿਹੜੇ ਵੱਖ ਵੱਖ ਸੀਜ਼ਨਾਂ ਵਾਲੇ ਜਿਹੜੇ ਪੌਦੇ ਆ ਉਹ ਲਗਾਏ ਜਾਂਦੇ ਆ ਕੁਛ ਪੌਦੇ ਜਿਹੜੇ ਘਰ ਜਿੰਨ੍ਹਾਂ ਨੂੰ ਅਸੀਂ ਬੀਜ਼ ਤੋਂ ਤਿਆਰ ਕਰ ਸਕਦੇ ਹਾਂ ਕੁਛ ਪੌਦੇ ਜਿਹੜੇ ਅਸੀਂ ਬਾਜ਼ਾਰ 'ਚੋਂ ਪਨੀਰੀ ਦੇ ਤੌਰ 'ਤੇ ਖ਼ਰੀਦ ਕੇ ਵੀ ਉਹਨਾਂ ਨੂੰ ਜਿਵੇਂ ਮਿਰਚਾਂ ਦੀ ਪਨੀਰੀ ਹੋ ਗਈ ਜਾਂ ਟਮਾਟਰਾਂ ਦੀ ਪਨੀਰੀ ਹੋ ਗਈ ਉਹ ਪਨੀਰੀ ਮਿਲ ਜਾਂਦੀ ਹੈ ਜਿੰਨ੍ਹਾਂ ਨੂੰ ਅਸੀਂ ਘਰ ਲਿਆ ਕੇ ਫਿਰ ਉਹਨਾਂ ਦੀ ਦੇਖ ਰੇਖ ਕਰਕੇ ਉਹਨਾਂ ਨੂੰ ਅਸੀਂ ਪਾਲ ਸਕਦੇ ਹਾਂ ਬਗੀਚੇ ਦੇ ਵਿੱਚ